ਸਵੈਟਰ ਬੁਣਨ ਦਾ ਮੈਨੂੰ ਬਚਪਨ ਤੋਂ ਹੀ ਬਹੁਤ ਜ਼ਿਆਦਾ ਸ਼ੌਂਕ ਸੀ ਮੈਂ ਸਵੈਟਰ ਬਹੁਤ ਬੁਣਦੀ ਸੀ ਪਰ ਹੁਣ ਮੈਂ ਇਹ ਕਹਿੰਦੀ ਹਾਂ ਕਿ ਸਵੈਟਰ ਕੋਟੀ ਜਾਕਟ ਬਣਾਉਣਾ ਮਤਲਬ ਕਿ ਹੁਣ ਮੇਰੇ ਵਾਸਤੇ ਕੋਈ ਔਖਾ ਨਹੀਂ ਪਰ ਇਸ ਦੇ ਵਿੱਚ ਆਮ ਔਰਤ ਜੋ ਸਵੈਟਰ ਕੋਟੀ ਬਣਾਉਂਦੀ ਹੈ ਉਹਨੂੰ ਗਲਾ ਬਣਾਉਣ ਦੇ ਵਿੱਚ ਬਹੁਤ ਦਿੱਕਤ ਆਉਂਦੀ ਹੈ ਕਿਉਂਕਿ ਜਿਹੜਾ ਸਵੈਟਰ ਜੈਂਟਸ ਦਾ ਸਵੈਟਰ ਬਣਾਉਣਾ ਹੁੰਦਾ ਉਹਦਾ ਜਿਹੜਾ ਗਲਾ ਉਹ ਗੋਲ ਗਲਾ ਬਣਾਉਣਾ ਹੋਵੇ ਤਾਂ ਸੌਖਾ ਪਰ ਜਿਹੜਾ ਔਖਾ ਉਹ ਵੀ ਗਲਾ ਬਣਾਉਣਾ ਹੋਵੇ ਜੈਂਟਸ ਦੇ ਸਵੈਟਰ ਦਾ ਤਾਂ ਉਹਦੇ ਜਿਹੜੇ ਕੁੰਡੇ ਆ ਖੱਬੇ ਖੱਬੇ ਸੱਜੇ ਔਰ ਪਿਛਲੇ ਪਾਸੋਂ ਇੱਕੋ ਜਿਹੇ ਚੱਕੇ ਜਾਂਦੇ ਤਿੰਨਾਂ ਪਾਸਿਆਂ ਤੋਂ ਹੀ

ਇੱਕ ਉਡਾ ਕੁੰਡਾ ਕੱਢਣਾ ਬਹੁਤ ਔਖਾ ਹੋ ਜਾਂਦਾ ਹੈਗਾ ਪਰ ਕਈ ਕਈ ਸੂਝਵਾਨ ਇਸਤਰੀਆਂ ਜਿਹੜੀਆਂ ਉਹ ਇਸ ਨੂੰ ਮਤਲਬ ਕਿ ਸਿੱਖ ਕੇ ਬਣਾ ਲੈਂਦੀਆਂ ਪਰ ਜਦੋਂ ਇਸ ਨੂੰ ਬਣਾਉਣਾ ਪੈਂਦਾ ਉਦੋਂ ਬਹੁਤ ਜ਼ਿਆਦਾ ਦਿਮਾਗ ਦੀ ਲੋੜ ਹੁੰਦੀ ਹੈ ਜਦੋਂ ਆਪਾਂ ਬਣਾਉਂਦੇ ਹਾਂ ਅਤੇ ਆਪਾਂ ਨੂੰ ਐਂ ਲੱਗਦਾ ਹੁੰਦਾ ਵੀ ਕਿਤੇ ਇਸ ਪਾਸੇ ਨਾ ਡਿੱਗ ਪਈ ਜਦੋਂ ਆਪਾਂ ਇੱਕ ਪਾਸਿਓਂ ਬਣਾਉਂਦੇ ਹਾਂ ਤਾਂ ਦੂਸਰੇ ਪਾਸਿਓ ਕੁੰਡਾ ਡਿੱਗ ਪੈਂਦਾ ਦੂਸਰੇ ਪਾਸੇ ਬਣਾਉਦੇ ਦੂਸਰੇ ਪਾਸੇ ਕੁੰਡਾ ਡਿੱਗ ਪੈਂਦਾ ਇਸ ਕਰਕੇ ਬਹੁਤ ਹੀ ਸੂਝਵਾਨ ਨਾਲ ਨਾ ਸੋਝੀ ਦੇ ਨਾਲ ਇਸ ਨੂੰ ਹੌਲੀ ਹੌਲੀ ਇਹ ਮਤਲਬ ਕਿ ਤਿੰਨ ਸਲਾਈਆਂ ਦੇ ਉੱਤੇ ਕੁੰਡੇ ਪਾਏ ਜਾਂਦੇ ਆ ਇੱਕ ਸਲਾਈ ਚੌਥੀ ਨਾਲ ਲਾਈ ਜਾਂਦੀ ਹੈ ਚੌਥੀ ਸਲਾਈ ਦੇ ਨਾਲ ਇਹਨੂੰ ਮਤਲਬ ਕਿ ਅਸੀਂ ਦੋਨਾਂ ਪਾਸਿਓਂ ਤੋਂ ਇੱਕ ਇੱਕ ਕੁੰਡਾ ਲੈ ਕੇ ਫਿਰ ਉਹਦੇ ਵਿੱਚ ਦੀ ਕੱਢ ਕੇ ਉਸਨੂੰ ਬੁਣਦੇ ਹਾਂ ਫਿਰ ਹੌਲੀ ਹੌਲੀ ਇਸ ਤਰ੍ਹਾਂ ਘੇਰੇ ਲੋਟ ਅਸੀਂ ਸਾਰੇ ਮਤਲਬ ਇਸ ਸਵੈਟਰ ਨੂੰ ਪੂਰਾ ਕਰ ਲੈਂਦੇ ਹਾਂ ਇਸ ਕਰਕੇ ਇਸਦਾ ਵੀ ਗਲਾ ਬਣਾਉਣਾ ਬਹੁਤ ਜ਼ਿਆਦਾ ਔਖਾ ਹੈਗਾ ਸਵੈਟਰ ਦਾ ਇਸ ਕਰਕੇ ਸਵੈਟਰ ਕੋਈ ਬਣਾਉਣਾ ਸੌਖਾ ਨਹੀਂ ਗਾ ਇਸ ਨੂੰ ਬਣਾਉਣ ਵਾਸਤੇ ਬਹੁਤ ਹੀ ਜ਼ਿਆਦਾ ਦਿਮਾਗ ਲੱਗਦਾ ਇਸ ਨੂੰ ਬਣਾਉਣ ਵਾਸਤੇ ਸਾਰਿਆਂ ਨੂੰ ਮਤਲਬ ਕਿ ਇਹ ਧਿਆਨ ਨਾਲ ਬਣਾਉਣਾ ਪੈਂਦਾ ਹੈਗਾ ਸਵੈਟਰ ਬਣਾਉਣਾ ਕੋਈ ਔਖਾ ਵੀ ਨਹੀਂ ਜੇ ਆਪਾਂ ਆਪਣੇ ਦਿਮਾਗ ਤੋਂ ਕੰਮ ਲਈਏ ਤਾਂ ਪਰ ਗਲਾ ਬਣਾਉਣਾ ਬਹੁਤ ਹੀ ਔਖਾ